ਮੰਗਲਵਾਰ ਵੈਸੇ ਤਾਂ ਸਾਡੇ ਘਰ ਸਾਰਾ ਦਿਨ ਬਿਜਲੀ ਆਉਂਦੀ ਰਹਿੰਦੀ ਹੈ ਪਰ ਮੰਗਲਵਾਰ ਅਤੇ ਸ਼ਨੀਵਾਰ ਬਹੁਤ ਵੱਡਾ ਕੱਟ ਲੱਗਦਾ ਹੈ ਜਿਸ ਦੇ ਕਾਰਨ ਬਹੁਤ ਜ਼ਿਆਦਾ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੱਖ ਵੱਖ ਮੌਸਮਾਂ ਦੌਰਾਨ ਵੀ ਜਦੋਂ ਬਿਜਲੀ ਦਾ ਕੱਟ ਲੱਗਦਾ ਹੈ ਗ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੱਖ ਵੱਖ ਮੌਸਮਾਂ ਦੇ ਦੌਰਾਨ ਬਿਜਲੀ ਦੇ ਕੱਟਣ ਕਾਰਨ ਪੇੜ ਪੌਦੇ ਵੀ ਡਿੱਗ ਜਾਂਦੇ ਹਨ ਅਤੇ ਕੱਟ ਬਹੁਤ ਵੱਡੇ ਲੱਗਦੇ ਹਨ ਵੱਖ ਵੱਖ ਮੌਸਮਾਂ ਦੇ ਦੌਰਾਨ ਸਾਡੀ ਕੱਟ ਲੱਗਣ ਕਰਕੇ ਜ਼ਿੰਦਗੀ ਵੀ ਬਹੁਤ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਸਾਡੇ ਘਰ ਵਿੱਚ ਰੋਟੀ ਬਣਾਉਣ ਦੀ ਵੀ ਮੁਸ਼ਕਿਲ ਆਉਂਦੀ ਹੈ ਲਾਈਟ ਨਾ ਹੋਣ ਕਰਕੇ ਗਰਮੀ ਬਹੁਤ ਲੱਗਦੀ ਹੈ ਅਤੇ ਗਰਮੀ ਦੇ ਕਾਰਨ ਬੱਚੇ ਵਿਲਕਦੇ ਹਨ ਅਤੇ ਪਾਣੀ ਵੀ ਨਹੀਂ ਹੁੰਦਾ ਅਤੇ ਜਦੋਂ ਕਿਤੇ ਸ ਸਕੂਲ ਬੱਚਿਆਂ ਨੇ ਜਾਣਾ ਹੁੰਦਾ ਹੈ ਅਤੇ ਰੋਟੀ ਬਣਾਉਣ ਵਿੱਚ ਵੀ ਦਿੱਕਤ ਆਉਂਦੀ ਹੈ ਇੱਥੋਂ ਤੱਕ ਕਿ ਸਾਨੂੰ ਪਾਣੀ ਪੀਣ ਨੂੰ ਵੀ ਨਹੀਂ ਮਿਲਦਾ ਸਾਫ ਸੁਥਰਾ ਅਤੇ ਗੁਆਂਢੀਆਂ ਦੇ ਘਰੋਂ ਜਾ ਕੇ ਪਾਣੀ ਲਿਆਉਣਾ ਪੈਂਦਾ ਹੈ ਕਈ ਵਾਰ ਤਾਂ ਇੰਨਾ ਜ਼ਿਆਦਾ ਕੱਟ ਲੱਗਦਾ ਹੈ ਜਿਸ ਕਰਕੇ ਸਾਡੀ ਜ਼ਿੰਦਗੀ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਅਤੇ ਕੱਟ ਲੱਗਣ ਨਾਲ ਸਾਡੀ ਜ਼ਿੰਦਗੀ 'ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਦਾ ਕੱਟ ਨਾ ਲਗਾਉਣ